ਘੋੜਸਵਾਰੀ ਕਰਨ ਲਈ ਘੋੜੇ ਦੀ ਚੋਣ ਕਰਦੇ ਸਮੇਂ ਸਾਨੂੰ ਮਹੱਤਵਪੂਰਨ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਘੋੜਾ ਚੰਗੀ ਨਸਲ ਦਾ ਹੋਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਵੱਧ ਤੋਂ ਵੱਧ ਰਫਤਾਰ ਪਕੜਨ ਵਿੱਚ ਕਾਮਯਾਬ ਰਹੇ ਘੋੜਾ ਤੰਦਰੁਸਤ ਹੋਣਾ ਚਾਹੀਦਾ ਹੈ ਅਤੇ ਘੋੜੇ ਦੀਆਂ ਸੁਰਖ ਖੁਰੀਆਂ ਦਾ ਸਹੀ ਤਰੀਕੇ ਨਾਲ ਲੱਗਿਆ ਹੋਣਾ ਚਾਹੀਦਾ ਹੈ ਘੋੜਾ ਜੰਗਲੀ ਨਹੀਂ ਹੋਣਾ ਚਾਹੀਦਾ ਘੋੜੇ ਨੂੰ ਸਹੀ ਤਰੀਕੇ ਨਾਲ ਸਿਖਲਾਈ ਦਿੱਤੀ ਹੋਣੀ ਚਾਹੀਦੀ ਹੈ ਘੋੜਾ ਸ਼ਾਂਤ ਸੁਭਾਅ ਦਾ ਹੋਣਾ ਚਾਹੀਦਾ ਹੈ ਅਤੇ ਘੋੜੇ ਦੀ ਕਾਠੀ ਨਰਮ ਹੋਣੀ ਚਾਹੀਦੀ ਹੈ ਤਾਂ ਜੋ ਘੋੜ ਸਵਾਰ ਸਹੀ ਤਰੀਕੇ ਨਾਲ ਬੈਠ ਕੇ ਸਵਾਰੀ ਕਰ ਸਕੇ ਅਤੇ ਘੋੜੇ ਦੀ ਲਗਾਮ ਸਹੀ ਤਰੀਕੇ ਨਾਲ ਬੰਨ੍ਹੀ ਹੋਣੀ ਚਾਹੀਦੀ ਹੈ ਘੋੜ ਸਵਾਰ ਨੂੰ ਘੋੜਾ ਚਲਾਉਣਾ ਸਹੀ ਤਰੀਕੇ ਨਾਲ ਆਉਣਾ ਚਾਹੀਦਾ ਉਹਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਘੋੜਿਆਂ ਦੀਆਂ